ਖੇਡ ਦੌਰਾਨ ਜ਼ਖਮੀ ਹੋਏ ਖਿਡਾਰੀਆਂ ਲਈ ਪ੍ਰਸ਼ਾਸਨ ਨੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਂਦੀਆਂ ਹਨ ਤਾਂ ਜੋ ਉਹ ਖਿਡਾਰੀਆਂ ਨੂੰ ਭਵਿੱਖ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਖਿਡਾਰੀਆਂ ਨੂੰ ਕਈ ਸਰਕਾਰੀ ਅਹੁਦਿਆਂ 'ਤੇ ਨਿਯੁਕਤ ਕਰ ਦਿੰਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਆਪਣਾ ਖਰਚਾ ਕਰ ਸਕਣ